ਨਮਸਤੇ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਉੱਥੇ ਨਵਾਂਸ਼ਹਿਰ ਤਿੰਨ ਪਾਰਕ ਹੈ ਇੱਕ ਪਾਰਕ ਪਿੰਡ ਵਿੱਚ ਹੈ ਅਤੇ ਦੋ ਪਾਰਕ ਸ਼ਹਿਰ ਵਿੱਚ ਹੈ ਜਿਹੜਾ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਫੇਮਸ ਹੈ ਖਟਕੜ ਕਲਾਂ ਦਾ ਅਤੇ ਬਾਕੀ ਦੋ ਸ਼ਹਿਰ 'ਚ ਹੈ ਤੁਸੀਂ ਦੱਸੋ ਤੁਸੀਂ ਕਿੱਥੇ ਆਉਣਾ ਹਾਂਜੀ ਹਾਂਜੀ ਮੈਂ ਖਟਕੜ ਕਲਾਂ ਜਾਂਦੀ ਹਾਂ ਉੱਥੇ ਜਿਹੜਾ ਪਿੰਡ ਹੈ ਮੀਨਿੰਗ ਕਿ ਉਹ ਤੁਹਾਨੂੰ ਪਤਾ ਹੈ ਵੀ ਉਹ ਭਗਤ ਸਿੰਘ ਦੇ ਨਾਲ ਭਗਤ ਸਿੰਘ ਦਾ ਹੈ ਪਿੰਡ ਅਤੇ ਉੱਥੋਂ ਦੇ ਇੱਕ ਮਿਊਜ਼ੀਅਮ ਹੈ ਅਤੇ ਪਾਰਕ ਉੱਥੇ ਦਾ ਬਹੁਤ ਸੋਹਣਾ ਉੱਥੇ ਫੁੱਲ ਵਗੈਰਾ ਲੱਗੇ ਹੈ ਹਾਂਜੀ ਅੱਗੇ ਤੁਸੀਂ ਦੱਸੋ ਤੁਸੀਂ ਕਿੱਥੇ ਕੁ ਹੋ ਤੁਸੀਂ ਕਦੋਂ ਕੁ ਆਉਣਾ ਓਕੇ ਤੁਸੀਂ ਬੱਸ 'ਚ ਆਉਂਗੇ ਜਾਂ ਫਿਰ ਟੈਕਸੀ ਓਕੇ ਮੇਰਾ ਪਿੰਡ ਨਾ ਰਸਤੇ ਵਿੱਚ ਆਉਂਦਾ ਤੁਸੀਂ ਮੈਨੂੰ ਨਾ ਪਿਕਅਪ ਕਰ ਲਿਓ ਇਕ ਦਿਨ ਪਹਿਲਾਂ ਕੋਲ ਕਰਕੇ ਦੱਸ ਦਿਓ ਜਦੋਂ ਵੀ ਤੁਹਾਡਾ ਦਿਲ ਕੀਤਾ ਆਉਣ ਦਾ ਹਾਂਜੀ ਕਿਉਂਕਿ ਮੈਂ ਵੀ ਆਪਣੇ ਫਰੈਂਡਸ ਨਾਲ ਉੱਥੇ ਜ਼ਿਆਦਾ ਘੁੰਮਣ ਜਾਂਦੇ ਹਾਂ ਨਾ ਖਟਕੜ ਕਲਾਂ ਹਾਂਜੀ ਫਿਰ ਤੁਸੀਂ ਉਸ ਅਕੋਰਡਿੰਗ ਦੱਸ ਦਿਓ ਵੀ ਤੁਸੀਂ ਨਵਾਂਸ਼ਹਿਰ ਦੇ ਸ਼ਹਿਰ ਵਾਲੇ ਪਾਰਕ 'ਚ ਘੁੰਮਣਾ ਹੈ ਜਾਂ ਫਿਰ ਤੁਸੀਂ ਖਟਕੜ ਕਲਾਂ ਘੁੰਮਣਾ ਹੈ ਓਕੇ ਵੈਸੇ ਜਿਹੜੀ ਐਂਟਰੀ ਹੈ ਉੱਥੇ ਦੀ ਸਾਰੀ ਜਗ੍ਹਾ ਫ੍ਰੀ ਹੈ ਨਵਾਂ ਜਿਹੜਾ ਸ਼ਹਿਰ ਵਿੱਚ ਦੋਨੋਂ ਉਹਦੇ ਵਿੱਚ ਵੀ ਫ੍ਰੀ ਹੈ ਜਿਹੜੀ ਖਟਕੜ ਕਲਾਂ ਹੈ ਉੱਥੇ ਵੀ ਫ੍ਰੀ ਹੈ ਐਂਟਰੀ ਬਾਕੀ ਤੁਸੀਂ ਆਪਣਾ ਡਿਸਾਈਡ ਕਰਕੇ ਮੈਨੂੰ ਕੋਲ ਕਰ ਦਿਓ ਇੱਕ ਦਿਨ ਪਹਿਲਾਂ ਹਾਂਜੀ ਠੀਕ ਹੈ ਥੈਂਕ ਯੂ